ਮੇਰੇ ਖੇਤਰ ਵਿੱਚ ਕਈ ਕਈ ਤਰ੍ਹਾਂ ਦੇ ਟਰੈਵਲ ਕੰਪਨੀਆਂ ਟਰੈਵਲ ਏਜੰਟਾਂ ਏਜੰਟ ਹਨ ਜਿਵੇਂ ਕਿ ਟੂਰ ਐਂਡ ਟਰੈਵਲਸ ਯੋਰਪ ਟੂਰ ਐਂਡ ਟਰੈਵਲਸ ਯੂ ਅ ਯੂਐੱਸਏ ਕੈਨੇਡਾ ਲਈ ਉਹ ਡੀਲ ਕਰਦੇ ਹਨ ਅਤੇ ਇਹ ਕੰਪਨੀਆਂ ਜ਼ਿਆਦਾਤਰ ਜਿਹੜੀਆਂ ਕੰਪਨੀਆਂ ਹਨ ਟਰੈਵਲ ਏਜੰਸੀਆਂ ਜੋ ਕਿ ਕੰਪਨੀਆਂ ਹਨ ਇਹ ਮੇਰੇ ਇਲਾਕੇ ਦੇ ਵਿੱਚ ਇਹ ਸਾਰੀਆਂ ਲਗਭਗ ਠੀਕ ਹਨ ਲੋਕਾਂ ਨੂੰ ਫਰੋਡ ਨਹੀਂ ਕਰਦੇ ਇਹ ਵਧੀਆ ਤਰੀਕੇ ਨਾਲ ਲੋਕਾਂ ਨਾਲ ਡੀਲ ਕਰਦੇ ਆ ਉਹਨਾਂ ਦਾ ਕਿਉਂਕਿ ਕਈ ਬੱਚੇ ਇਹਨਾਂ ਦਿਨਾਂ ਦੇ ਵਿੱਚ ਵੀ ਬਾਹਰ ਨੂੰ ਪੜ੍ਹਾਈ ਬੇਸ 'ਤੇ ਪੜ੍ਹਨ ਗਏ ਹਨ ਇਸ ਇਲਾਕੇ ਦੇ ਵਿੱਚ ਜਿਵੇਂ ਕਿ ਵਿਜ਼ਨਵੇ ਹੈ ਆਪਣੇ ਕੇਰਲਾ ਐਜੂਕੇਸ਼ਨ ਟੂਰਿਸਟ ਹੈਗੀ ਆ ਥੋਂ ਵੀ ਨਿਆਣੇ ਆਪਣਾ ਵੀਜ਼ਾ ਲਵਾ ਕੇ ਬਾਹਰਲੀਆਂ ਕੰਟਰੀਆਂ ਨੂੰ ਜਾਂਦੇ ਹਨ ਅਤੇ ਡੀਲਿੰਗ ਉਹਨਾਂ ਦੀ ਵਧੀਆ ਹੁੰਦੀ ਹੈ ਅਤੇ ਇਹ ਇੰਝ ਨਹੀਂ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਕਈ ਜਗ੍ਹਾ ਅ ਫਰੋਡ ਏਜੰਟ ਮਿਲਦੇ ਹਨ ਇੱਥੇ ਨਵਾਂ ਸ਼ਹਿਰ ਮੇਰੇ ਖੇਤਰ ਵਿੱਚ ਨਹੀਂ ਮਿਲਦੇ ਇਸ ਤਰੀਕੇ ਨਾਲ ਅਤੇ ਜ਼ਿਆਦਾਤਰ ਜੋ ਕੱਟੇ ਟਰੈਵਲ ਏਜੰਸੀ ਉਹ ਵਧੀਆ ਹਨ